ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਰੁੱਖ ਸਾਡੇ ਲਈ ਕੁਦਰਤ ਦੀ ਬਹੁਮੁੱਲੀ ਦਾਤ ਹੈ ਇਹਨਾਂ ਦੇ ਬਿਨਾਂ ਅਸੀਂ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਰੁੱਖ ਕੇਵਲ ਮਾਨਵ ਜਾਤੀ ਲਈ ਹੀ ਨਹੀਂ ਸਗੋਂ ਧਰਤੀ ਉੱਤੇ ਰਹਿੰਦੇ ਪ੍ਰਾਣੀਆਂ ਲਈ ਬਹੁਤ ਜ਼ਰੂਰੀ ਹਨ ਰੁੱਖ ਨਾ ਹੁੰਦੇ ਤਾਂ ਇਹ ਸਾਰੀ ਧਰਤੀ ਵੀਰਾਨ ਹੋਣੀ ਸੀ ਰੁੱਖ ਧਰਤੀ 'ਤੇ ਰਹਿਣ ਵਾਲੇ ਜੀਵਨ ਦਾ ਪਾਲਣਹਾਰ ਹੈ ਰੁੱਖ ਹਵਾ ਨੂੰ ਸ਼ੁੱਧ ਕਰਦੇ ਹਨ ਰੁੱਖ ਸਾਡੇ ਦੁਆਰਾ ਛੱਡੀ ਗਈ ਕਾਰਬਨ ਡਾਈਆਕਸਾਈਡ ਚੂਸਦੇ ਹਨ ਅਤੇ ਆਕਸੀਜਨ ਛੱਡਦੇ ਹਨ ਜੋ ਕਿ ਸਾਹ ਲੈਣ ਲਈ ਬਹੁਤ ਜ਼ਰੂਰੀ ਹੈ ਮੇਰੇ ਇਲਾਕੇ ਵਿੱਚ ਲੋਕ ਪਿਛਲੇ ਕੁਝ ਸਾਲਾਂ ਤੋਂ ਪੌਦਾ ਵਾਧਾ ਕਰਨ ਲਈ ਵਧੇਰੇ ਪਰਿਆਸ ਪਰਿਆਸ ਕੀਤੇ ਹਨ ਆਮ ਲੋਕਾਂ ਆਮ ਲੋਕ ਵੱਖ ਵੱਖ ਤਰ੍ਹਾਂ ਪੌਦੇ ਲਾ ਰਹੇ ਹਨ ਅਸੀਂ ਇਲਾਕੇ ਵਿੱਚ ਵੱਧ ਤੋਂ ਵੱਧ ਪੌਦੇ ਲਾ ਰਹੇ ਹਾਂ ਜੋ ਇੱਕ ਸ਼ਾਨਦਾਰ ਅਤੇ ਸ਼ਵੱਛ ਵਾਤਾਵਰਨ ਨੂੰ ਨਿਰੰਤਰ ਬਣਾਏ ਰੱਖਦੇ ਹਨ ਸਰਕਾਰ ਪਹਿਲਾਂ ਤੋਂ ਹੀ ਲੋਕਾਂ ਨੂੰ ਪੌਦੇ ਲਾਉਣ ਦੀ ਸਲਾਹ ਦਿੰਦੀ ਹੈ ਅਤੇ ਵਿਭਾਗੀ ਸੰਗਠਨਾਂ ਦੁਆਰਾ ਪੌਦੇ ਲਾਣ ਅਤੇ ਸੁਰੱਖਿਆ ਲਈ ਸਹਾਇਤਾ ਦਿੱਤੀ ਜਾ ਸਕਦੀ ਹੈ ਇਸ ਨਤੀਜੇ ਵਿੱਚ ਸਾਡੇ ਇਲਾਕੇ ਵਿੱਚ ਹਰਿਆਲੀ ਦਾ ਆਨੰਦ ਲੈਣ ਲਈ ਲੋਕ ਸੁਖੇਤ ਹੋ ਰਹੇ ਹਨ ਅਤੇ ਇੱਕ ਸ਼ਿਵੱਸ ਸੁਖ ਆਤਮ ਵਾਤਾਵਰਨ ਦੀ ਦੇਨ ਹੈ ਸਾਨੂੰ ਵੱਧ ਤੋਂ ਵੱਧ ਆਪਣੇ ਘਰਾਂ ਅਤੇ ਖੇਤਾਂ ਵਿੱਚ ਰੁੱਖ ਲਗਾਉਣੇ ਚਾਹੀਦੇ ਹਨ ਆਪਾਂ ਆਪਣੇ ਜਨਮ ਦਿਨ 'ਤੇ ਰੁੱਖ ਲਗਾ ਕੇ ਵੀ ਮਨਾ ਸਕਦੇ ਹਾਂ ਸਾਡੇ ਪਿੰਡ ਵਿੱਚ ਇੱਕ ਕਲੱਬ ਬਣਾਇਆ ਹੋਇਆ ਹੈ ਜੋ ਪਿੰਡ ਵਿੱਚ ਰੁੱਖ ਲਗਾਉਂਦਾ ਹੈ ਉਹ ਹਰ ਕਿਸੇ ਦੇ ਜਨਮ ਦਿਨ ਮੌਕੇ ਉਦਘਾਟਨ ਮੌਕੇ ਪੁਰਸਕਾਰ ਵਜੋਂ ਸਭ ਨੂੰ ਰੁੱਖ ਭੇਟ ਕਰਦੇ ਹਨ ਅਤੇ ਉਹਨਾਂ ਦੀ ਸੇਵਾ ਸੰਭਾਲ ਕਰਦੇ ਹਨ ਸਾਨੂੰ ਰੁੱਖਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ ਸਾਨੂੰ ਰੁੱਖ ਤੋਂ ਆਕਸੀਜਨ ਪ੍ਰਾਪਤ ਹੁੰਦੀ ਹੈ ਆਕਸੀਜਨ ਦੇ ਨਾਲ ਨਾਲ ਸਾਨੂੰ ਰੁੱਖਾਂ ਤੋਂ ਭੋਜਨ ਫਲ ਪ੍ਰਾਪਤ ਹੁੰਦੇ ਹਨ ਜੇਕਰ ਅਸੀਂ ਰੁੱਖਾਂ ਦੀ ਕਟਾਈ ਕਰਦੇ ਹਾਂ ਤਾਂ ਸਾਨੂੰ ਬਿਮਾਰੀਆਂ ਵੀ ਬਹੁਤ ਲੱਗਦੀਆਂ ਹਨ ਅਤੇ ਸਾਹ ਲੈਣ ਵਿੱਚ ਵੀ ਸਮੱਸਿਆ ਆਉਂਦੀ ਹੈ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਰੁੱਖਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ